ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਹਾਂਜੀ ਮੈਂ ਹਰਦਿਆਲ ਸਿੰਘ ਗੱਲ ਕਰ ਰਿਹਾ ਜੀ ਹਾਂਜੀ ਮੈਨੂੰ ਸੈਕਟਰ ਚੋਂਤੀ ਦੇ ਵਿੱਚ ਰੈਂਟ ਦੇ ਲਈ ਘਰ ਚਾਹੀਦਾ ਸੀਗਾ ਜੀ ਹਾਂਜੀ ਹਾਂਜੀ ਨਹੀਂ ਪਰਿਵਾਰ ਲਈ ਦਿਖਾ ਦਿਓ ਜੀ ਅੱਛਾ ਜੀ ਇਹਨਾਂ ਦੇ ਵਿੱਚ ਕੀ ਫੈਸਲਿਟੀ ਸੁਵਿਧਾਵਾਂ ਮਿਲਣਗੀਆਂ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਇਹਨਾਂ ਦਾ ਕਰਾਰ ਕਿਰਾਇਆ ਕੀ ਹੋਊਗਾ ਸਰ ਜਿਹੜਾ ਜਮੀਨ 'ਤੇ ਤੁਸੀਂ ਕਿਹਾ ਸੀ ਪਹਿਲੀ ਮੰਜ਼ਿਲ 'ਤੇ ਆ ਅੱਛਾ ਇੱਕ ਇੱਕ ਬੀ ਐਚ ਕੇ ਦਾ

ਹਾਂਜੀ ਬਿਜਲੀ ਪਾਣੀ ਦਾ ਅਲੱਗ ਹੈ ਜੀ ਅੱਛਾ ਉਹ ਸਾਨੂੰ ਖੁਦ ਨੂੰ ਭਰਨਾ ਪਊਗਾ ਹਾਂਜੀ

ਕੋਈ ਗੈਸ ਦਾ ਖਰਚਾ ਕੋਈ ਅਲੱਗ ਤੋਂ

ਅੱਛਾ ਜੀ ਕੋਈ ਨੇੜੇ ਤੇੜੇ ਪਾਰਕ ਵਗੈਰਾ ਘੁੰਮਣ ਲਈ ਜਾਂ ਸੁਬਹਾ ਸ਼ਾਮ ਸੈਰ ਕਰਨ ਦੇ ਲਈ ਕੋਈ ਲੋਕੇਸ਼ਨ ਇੱਦਾਂ ਦੀ

ਓਕੇ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਸੀਂ ਤੁਹਾਨੂੰ ਮਿਲਦੇ ਹਾਂ ਆ ਕੇ ਠੀਕ ਹੈ ਜੀ